ਮੈਂ ਆਪਣੇ ਦਿਨ ਦੇ ਵਿੱਚ ਲਗਭਗ ਪੰਜ ਤੋਂ ਛੇ ਘੰਟੇ ਆਪਣਾ ਸਮਾਂ ਮੋਬਾਇਲ ਉੱਤੇ ਬਿਤਾਉਂਦਾ ਹਾਂ ਅਤੇ ਇਸ ਪੰਜ ਤੋਂ ਛੇ ਘੰਟੇ ਦੇ ਸਮੇਂ ਵਿੱਚ ਮੈਂ ਆਪਣੇ ਮੋਬਾਇਲ ਵਿੱਚ ਕਈ ਤਰ੍ਹਾਂ ਦੀ ਪੜ੍ਹਾਈ ਦੀਆਂ ਵੀਡੀਓ ਦੇਖਦਾ ਹਾਂ ਜੋ ਕਿ ਮੇਰੇ ਮਾਨਸਿਕ ਰੂਪ ਤੋਂ ਮੈਨੂੰ ਚੰਗਾ ਕਰਦੀ ਹੈ ਅਤੇ ਜਦੋਂ ਮੈਂ ਪੜ੍ਹਾਈ ਕਰਕੇ ਫੋਨ ਤੋਂ ਹਟ ਜਾਂਦਾ ਲਗਭਗ ਦੋ ਤੋਂ ਤਿੰਨ ਘੰਟੇ ਮੈਂ ਇਸ ਵਿੱਚ ਪੜ੍ਹਾਈ ਦੀ ਵੀਡੀਓ ਦੇਖਦਾ ਹਾਂ ਅਤੇ ਅੱਧਾ ਤੋਂ ਪੌਣਾ ਘੰਟਾ ਮੈਂ ਆਪਣਾ ਐਂਟਰਟੇਨਮੈਂਟ ਕਰਦਾ ਹਾਂ ਜਿਸ ਵਿੱਚ ਮੈਂ ਇੰਸਟਾਗ੍ਰਾਮ ਚਲਾਉਂਦਾ ਹਾਂ ਸਨੈਪਚੈਟ ਚਲਾਉਂਦਾ ਹਾਂ ਅਤੇ ਯੂਟੀਊਬ 'ਤੇ ਕੁਝ ਮਸਤੀ ਮਜ਼ਾਕ ਵਾਲੀਆਂ ਵੀਡੀਓ ਦੇਖਦਾ ਹਾਂ ਪ੍ਰੰਤੂ ਜਦੋਂ ਮੈਂ ਇਸ ਤੋਂ ਬਾਅਦ ਵੀ ਬੋਰ ਹੋ ਜਾਂਦਾ ਹਾਂ ਤਾਂ ਫਿਰ ਮੈਂ ਆਪਣੇ ਮੋਬਾਈਲ ਦੇ ਉੱਤੇ ਮੇਰੇ ਜਾਣਕਾਰਾਂ ਨੂੰ ਫੋਨ ਕਰਦਾ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਹਾਂ ਜਿਸ ਨਾਲ ਮੇਰਾ ਥੋੜ੍ਹਾ ਮਾਇੰਡ ਫਰੈਸ਼ ਹੋ ਜਾਂਦਾ ਹੈ ਅਤੇ ਇੱਦਾਂ ਹੀ ਕਰਦੇ ਕਰਦੇ ਮੇਰੇ ਦਿਨ ਵਿੱਚ ਪੰਜ ਛੇ ਘੰਟੇ ਮੇਰਾ ਫੋਨ ਚਲ ਜਾਂਦਾ ਹੈ